ਮਹਿੰਦਰਾ ਕਾਲਜ ਪਟਿਆਲਾ ਵਿੱਚ ਦੋ ਹਜ਼ਾਰ ਸਤਾਰਾਂ ਵਿੱਚ ਮੈਂ ਬੀ ਏ ਦੌਰਾਨ ਇੱਕ ਫੋਕਰ ਐਸਟਰਾ ਵਿੱਚ ਪਾਰਟੀਸੀਪੇਟ ਕੀਤਾ ਜਿਸ ਵਿੱਚ ਮੈਂ ਬਤੌੌਰ ਤੂੰਬੀ ਪਲੇਅਰ ਦੇ ਨਾਲ ਆਪਣਾ ਕੰਮ ਕੀਤਾ ਪਰ ਉਸ ਦੀ ਜਦੋਂ ਰੇਹੱਸਲ ਹੁੰਦੀ ਸੀ ਇੱਕ ਅਜੇ ਸ਼ਰਮਾ ਨਾਮ ਦਾ ਸਿਖਿਆਰਥੀ ਜੋ ਕਿ ਸਾਡਾ ਟੀਮ ਮੈਂਬਰ ਸੀ ਉਹ ਬਹੁਤ ਹੀ ਧੋਂਸ ਜਮਾਉਂਦਾ ਸੀ ਅਤੇ ਆਪਣੇ ਆਪ ਨੂੰ ਸੀਨੀਅਰ ਹੋਣ ਦੇ ਨਾਤੇ ਰੈਗਿੰਗ ਕਰਨ ਦੀ ਕੋਸ਼ਿਸ਼ ਵੀ ਕਰਦਾ ਸੀ ਪਰ ਅਸੀਂ ਕੁਛ ਦਿਨ ਉਸ ਦੀਆਂ ਹਰਕਤਾਂ ਤੋਂ ਜਾਣੂ ਹੋਏ ਉਸ ਤੋਂ ਬਾਅਦ ਮੈਂ ਅਤੇ ਮੇਰੇ ਸਾਥੀਆਂ ਨੇ ਸਲਾਹ ਬਣਾਈ ਕਿ ਇਸ ਦੀ ਸ਼ਿਕਾਇਤ ਸਾਡੇ ਹੈੱਡਮਾਸਟਰ ਨੂੰ ਕੀਤੀ ਜਾਵੇ ਅਤੇ ਅਸੀਂ ਰਾਏ ਬਣਾ ਕੇ ਚਾਰ ਜਣਿਆਂ ਨੇ ਉਹਨਾਂ ਦੀ ਸ਼ਿਕਾਇਤ ਆਪਣੇ ਪ੍ਰਿੰਸੀਪਲ ਸਾਹਿਬਾਨ ਕੋਲ ਵੀ ਜਾ ਕੇ ਕੀਤੀ ਅਤੇ ਉਹਨਾਂ ਨੇ ਸਾਡੀ ਗੱਲਬਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਉਸਨੂੰ ਆਪਣੇ ਆਫਿਸ ਵਿੱਚ ਬੁਲਾ ਕੇ ਤਾੜਨਾ ਦਿੱਤੀ ਕਿ ਤਾਂ ਜੋ ਅੱਗੇ ਵਾਸਤੇ ਉਹ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਉਸ ਤੋਂ ਬਾਅਦ ਉਸਨੇ ਸਾਡੇ ਤੋਂ ਆ ਕੇ ਦੂਜੇ ਦਿਨ ਮਾਫ਼ੀ ਮੰਗੀ ਅਤੇ ਅਸੀਂ ਉਸਨੂੰ ਮਾਫ ਵੀ ਕਰ ਦਿੱਤਾ ਅਤੇ ਅੱਜ ਤੱਕ ਅਸੀਂ ਚੰਗੇ ਦੋਸਤ ਹਾਂ ਇਹ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵਿਲੱਖਣ ਤਜ਼ਰਬਾ ਸੀ